ਹੈਲੋ ਗੁੱਡ ਮੋਰਨਿੰਗ ਸਰ ਸਰ ਤੁਸੀਂ ਪਲੇਸਮੈਂਟ ਇੰਚਾਰਜ ਬੋਲ ਰਹੇ ਹੋ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚੋਂ ਸਰ ਮੈਂ ਨਾ ਜੋਬ ਪਲੇਸਮੈਂਟ ਬਾਰੇ ਪੁੱਛਣਾ ਸੀ ਕੋਈ ਅੰਮ੍ਰਿਤਸਰ 'ਚ ਅਵੇਲੇਬਲ ਹੈ ਕਿ ਨਹੀਂ ਸਰ ਮੇਰਾ ਬੀਟੈਕ ਸੀ ਏਟਥ ਸਮੈਸਟਰ ਸਰ ਮੇਰੇ ਮਤਲਬ ਕਿ ਸਾਰੇ ਫਰੈਂਡਸ ਦੀ ਜੋਬ ਲੱਗ ਗਈ ਮੇਰੀ ਰਹਿ ਗਈ ਆ ਹਾਂਜੀ ਸਰ ਠੀਕ ਆ ਸਰ ਥੈਂਕ ਯੂ ਸਰ